ਹੈਂਡਮੇਡ ਕਲੋਥ ਅਤੇ ਬ ਰੈਡੀਮੇਡ ਕਲੋਥਾਂ ਦੇ ਵਿੱਚ ਕੀ ਫਰਕ ਹੁੰਦਾ ਹੈ ਹੈਂਡਮੈਡ ਕਲੋਥ ਅਤੇ ਰੈਡੀਮੇਡ ਕਲੋਥਸ ਦੇ ਵਿੱਚ ਇਹ ਫਰਕ ਹੁੰਦਾ ਹੈ ਕਿ ਰੈਡੀਮੇਡ ਕਲੋਥ ਦੀ ਸਿਲਾਈ ਸ ਕਈ ਵਾਰੀ ਜਲਦੀ ਖੁੱਲ੍ਹ ਜਾਂਦੀ ਹੈ ਤਾਂ ਕਿ ਜੋ ਹੱਥ ਦੇ ਬੁਣੇ ਹੋਏ ਹੁੰਦੇ ਹਨ ਉਹਨਾਂ ਦੀ ਇੰਨੀ ਜਲਦੀ ਨਹੀਂ ਖੁੱਲ੍ਹਦੀ ਲੋਕ ਰੈਡੀਮੇਡ ਕਲੋਥ ਪਾਉਣਾ ਇਸ ਕਰਕੇ ਪਸੰਦ ਕਰਦੇ ਹਨ ਤਾਂ ਕਿ ਜੋ ਹੱਥ ਦੀ ਸਿਲਾਈ ਵਾਲੇ ਕੱਪੜੇ ਹਨ ਉਹਨਾਂ ਦੀ ਸਿਲਾਈ ਬਹੁਤ ਜ਼ਿਆਦਾ ਹੁੰਦੀ ਹੈ ਰੈਡੀਮੇਡ ਦੀ ਸਿਲਾਈ ਜਿਹੜੀ ਹੈ ਘੱਟ ਹੁੰਦੀ ਹੈ ਇਸ ਕਰਕੇ ਲੋਕ ਜਿਹੜੇ ਹੈ ਰੈਡੀਮੇਡ ਕੱਪੜੇ ਪਾਉਣਾ ਪਸੰਦ ਕਰਦੇ ਹਨ ਉਹਨੂੰ ਈਜ਼ੀਲੀ ਤੁਸੀਂ ਬਾਏ ਕਰਕੇ ਵੇਅਰ ਕਰ ਸਕਦੇ ਹੋ